ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਨਵਦੀਪ ਬੋਲ ਰਿਹਾ ਜੀ ਮਾਨਸਾ ਤੋਂ ਮਾਨਸਾ ਤੋਂ ਬੋਲ ਰਿਹਾ ਜੀ ਵਾਰਡ ਨੰਬਰ ਦੋ ਤੋਂ ਇੱਕ ਇੱਕ ਨਾ ਸਰ ਇਹ ਅਸੀਂ ਖ਼ਬਰ ਲਗਵਾਉਣੀ ਸੀ ਨਾ ਮਾਨਸਾ ਦੇ ਵਿੱਚ ਓਵਰ ਫਲੋ ਬੜਾ ਹੋ ਰਿਹਾ ਪਾਣੀ ਨਾ ਸੀਵਰੇਜ ਦੀ ਬਲੋਕੇਜ ਬਹੁਤ ਪ੍ਰੋਬਲਮ ਆ ਰਹੀ ਹੈ ਲੰਘਣ ਲੂਘਣ ਦੇ ਨਾ ਹਾਂਜੀ ਇਹਦੀ ਖਖ਼ਰ ਅਗਰ ਲੱਗ ਜਾਵੇ ਕਿਉਂਕਿ ਨਾ ਸਾਰੇ ਮਹ ਸਾਰੇ ਮਹੱਲਾ ਵਾਸੀ ਪ੍ਰੋ ਇਸ ਚੀਜ਼ ਤੋਂ ਪ੍ਰੇਸ਼ਾਨ ਨੇ ਗੰਦਗੀ ਬੜੀ ਹੈ ਮੱਛਰ ਬੜਾ ਹੋ ਜਾਂਦਾ ਹੈ ਅਤੇ ਪਲੀਸ ਕ੍ਰਿਪਾ ਕਰਕੇ ਤੁਸੀਂ ਹਾਂਜੀ ਇਹਦੀ ਤੁਸੀਂ ਖ਼ਬਰ ਅਗਰ ਭੇਜ ਦਿਓ ਤਾਂ ਅਸੀਂ ਇਕੱਠੇ ਹੋ ਜਾਂਗੇ ਸਾਰੇ ਮੁਹੱਲਾ ਵਾਸੀ ਫਿਰ ਤੁਹਾਨੂੰ ਬੁਲਾ ਲਾਂਗੇ ਉਸ ਤੋਂ ਬਾਅਦ ਤੁਸੀਂ ਵਾਇਟ ਵਗੈਰਾ ਜਾਂ ਉਹ ਲੈਣੀ ਹੋਈ ਜੋ ਵੀ ਅਸੀਂ ਸਾਰੇ ਬੰਦੇ ਹਾਜ਼ਰ ਹੋਵਾਂਗੇ ਉੱਥੇ

ਹਾਂ ਠੀਕ ਹੈ ਜੀ ਹਾਂ ਕੱਲ੍ਹ ਆ ਜਾਇਓ ਚਾਹੇ ਕੱਲ੍ਹ ਮੈਂ ਸਾਰਿਆਂ ਨੂੰ ਹਾਂ ਮੈਂ ਕੱਲ੍ਹ ਹਾਂ ਮੈਂ ਮੁਹੱਲਾ ਵਾਸੀਆਂ ਨੂੰ ਮੈਸਜ ਲਗਾ ਦਊਂਗਾ ਅਤੇ ਹਾਂ ਪਲੀਸ ਜੇ ਥੋੜ੍ਹੀ ਸ ਹੈਲਪ ਕਰਿਓ ਜੀ ਹਾਂ ਠੀਕ ਹੈ ਜੀ ਓਕੇ ਬਾਏ ਜੀ